ਵੈਸੇ ਤਾਂ ਮੈਂ ਆਪਣੇ ਜੀਵਨ ਵਿੱਚ ਕਈ ਤਰ੍ਹਾਂ ਦੀਆਂ ਯਾਤਰਾ ਕੀਤੀਆਂ ਪਰ ਕੁਝ ਅਜਿਹੀ ਜਗ੍ਹਾ ਵੀ ਸੀ ਜਿਨ੍ਹਾਂ 'ਚ ਜਾ ਕੇ ਮੇਰਾ ਦਿਲ ਬਹੁਤ ਖੁਸ਼ ਹੋਇਆ ਮੇਰਾ ਮਨ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪ੍ਰਭਾਵਿਤ ਹੋਇਆ ਜਿਵੇਂ ਕਿ ਮੈਂ ਪਿੱਛੇ ਜੇ ਏ ਮਾਤਾ ਨੈਣਾਂ ਦੇਵੀ ਗਿਆ ਸੀ ਠੀਕ ਆ ਜੋ ਮੈਂ ਉੱਥੇ ਸੋਚਿਆ ਸੀ ਕਿ ਇੱਥੇ ਏ ਬਹੁਤ ਜ਼ਿਆਦਾ ਵਿਊ ਜੋ ਆਪਣੇ ਸੋਚ ਤੋਂ ਵਧੀਆ ਸੀ ਉਹ ਤੋਂ ਬਹੁਤ ਜ਼ਿਆਦਾ ਵਧੀਆ ਹੋਇਆ ਠੀਕ ਹੈ ਮੈਂ ਉੱਥੇ ਸੋਚਿਆ ਸੀ ਕਿ ਬਹੁਤ ਜ਼ਿਆਦਾ ਵਾਤਾਵਰਨ ਸਹੀ ਨਹੀਂ ਹੋਣਾ ਪਰ ਜਦੋਂ ਮੈਂ ਉੱਥੇ ਗਿਆ ਤਾਂ ਮੇਰੀ ਸੋਚ ਹੀ ਬਦਲ ਗਈ ਠੀਕ ਆ ਮਾਤਾ 'ਤੇ ਬਹੁਤ ਜ਼ਿਆਦਾ ਮਾਹੌਲ ਕਹਿ ਲਾ ਬਹੁਤ ਵਧੀਆ ਸੀ ਉੱਥੇ ਦਾ ਵਾਤਾਵਰਨ ਉੱਥੇ ਦੀ ਜਲਵਾਯੂ ਉੱਥੇ ਦੀ ਹਵਾ ਬਹੁਤ ਜ਼ਿਆਦਾ ਸ ਸੰਤੁਸ਼ਟੀ ਲਾਇਕ ਸੀ ਅਤੇ ਜਿਹੜੇ ਮ ਉੱਥੇ ਦੇ ਉੱਥੇ ਦੇ ਆਂਢ ਆ ਆਲੇ ਦੁਆਲੇ ਸੀ ਬਹੁਤ ਵਾਤਾਵਰਨ ਦੇਖਣਾ ਬਹੁਤ ਹੀ ਵਧੀਆ ਸੀ ਜੇ ਅਤੇ ਉੱਥੇ ਜੋ ਦਰਸ਼ਨ ਜੋ ਜਿਸ ਹਿਸਾਬ ਨਾਲ ਉਨ੍ਹਾਂ ਨੇ ਮੰਦਰ ਬਣਾਇਆ ਹੋਇਆ ਸੀ ਉਹ ਵੀ ਬਹੁਤ ਵਧੀਆ ਸੀ ਉੱਥੇ ਸਾਰੀ ਤਰ੍ਹਾਂ ਦੀ ਫਸਿਲਟੀ ਜਿਵੇਂ ਕਿ ਦੁਕਾਨਾਂ ਦੁਕਾਨਾਂ ਹੋਰ ਵੀ ਖਾਣ ਪੀਣ ਦਾ ਚੀਜ਼ ਖਿਲੋਣਿਆਂ ਦੀਆਂ ਹੋਰ ਵੀ ਕਈ ਤਰ੍ਹਾਂ ਦੀਆਂ ਜ ਦੁਕਾਨਾਂ ਲੱਗੀਆਂ ਹੋਈਆਂ ਸੀ ਜਿਸ ਕਾਰਨ ਉੱਥੇ ਦਾ ਮਾਹੌਲ ਹੋਰ ਵੀ ਵਧੀਆ ਬਣ ਗਿਆ ਠੀਕ ਆ ਉੱਥੇ ਜਿਸ ਹਿਸਾਬ ਨਾਲ ਲੋਕਾਂ ਨੂੰ ਮੱਥਾ ਟੇਕਣ ਦਾ ਤਰੀਕਾ ਜਾਂ ਕਹਿ ਲਉ ਕਿ ਮੱਥਾ ਟੇਕਣ ਦਾ ਮੱਥਾ ਟੇਕਣ ਲਈ ਉਨ੍ਹਾਂ ਨੇ ਰੇਲਿੰਗ ਲਾਈ ਹੋਈ ਸੀ ਉਹ ਵੀ ਬਹੁਤ ਵਧੀਆ ਸੀ ਜਿਸ ਨਾਲ ਬਹੁਤ ਜ਼ਿਆਦਾ ਭੀੜ ਨਹੀਂ ਲੱਗ ਰਹੀ ਸੀ ਤਾਂ ਇਸ ਨਾਲ ਇਸ ਤਰ੍ਹਾਂ ਮੇਰਾ ਉੱਥੇ ਜਾਣ ਨਾਲ ਬਹੁਤ ਵਧੀਆ ਮੱਥਾ ਟੇਕ ਹੋਇਆ ਅਤੇ ਉੱਥੇ ਮੈਂ ਕੋਈ ਹੈ ਰੱਸ਼ 'ਚ ਨਹੀਂ ਹੋਈ ਬਹੁਤ ਜ਼ਿਆਦਾ ਵਧੀਆ ਰਿਹਾ ਕਿਉਂਕਿ ਮੇਰੀ ਲਾਈਫ਼ ਦਾ ਸਭ ਤੋਂ ਵਧੀਆ ਯਾਤਰਾ ਰਹੀ